ਹਾਂਜੀ ਅੱਜ ਦੇ ਸੰਸਾਰ ਦੇ ਵਿੱਚ ਜਿਹੜਾ ਕੀ ਹੈ ਬੀਮਾ ਕਰਵਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕੀ ਪਤਾ ਲੱਗਦਾ ਜ਼ਿੰਦਗੀ ਦਾ ਹੈ ਨਾ ਵੀ ਕਦੋਂ ਵੀ ਕੁਛ ਹੋ ਸਕਦਾ ਹੈਗਾ ਆਪਾਂ ਨੂੰ ਆਪਣੇ ਵੀ ਬੀਮੇ ਵੀ ਆਪਾਂ ਨੂੰ ਮਨੁੱਖਾਂ ਦੇ ਵੀ ਚੱਲਦੇ ਨੇ ਫਿਰ ਆਪਣੇ ਵਹੀਕਲ ਦੇ ਵੀ ਮੋਟਰਸਾਈਕਲ ਵਗੈਰਾ ਕਾਰ ਹੈ ਨਾ ਇਹ ਸਾਰੀਆਂ ਚੀਜ਼ਾਂ ਦੇ ਬੀਮੇ ਜਿਹੜੇ ਕਰਵਾਉਣੇ ਚਾਹੀਦੇ ਹੈ ਹੁਣ ਤਾਂ ਹਰ ਇੱਕ ਚੀਜ਼ ਦਾ ਹੀ ਬੀਮਾ ਹੋਣ ਲੱਗ ਗਿਆ ਕੰਪਨੀ ਨਾਲ ਦੀ ਨਾਲ ਕਰਦੀ ਈਵਨ ਕਿ ਆਪਾਂ ਮੋਬਾਈਲ ਵੀ ਲੈਂਦੇ ਹਾਂ ਤਾਂ ਉਹਦਾ ਵੀ ਜਿਹੜਾ ਕਿ ਬੀਮਾ ਹੁੰਦਾ ਹੈਗਾ ਵੀ ਇਹ ਸਕਰੀਨ ਵਗੈਰਾ ਟੁੱਟ ਜਾਂਦੀ ਆ ਤਾਂ ਉਹ ਈਜ਼ੀਲੀ ਫਿਰ ਆਪਣਾ ਕੀ ਆ ਬੀਮਾ ਕੰਪਨੀ ਤੋਂ ਜਿਹੜਾ ਕਿ ਉਹਦੀ ਜਿਹੜਾ ਆਪ ਲਿਆ ਜਾਂਦਾ ਗਾ ਮੁਆਵਜ਼ਾ ਲਿਆ ਜਾਂਦਾ ਨਾ ਜਦੋਂ ਆਪਣਾ ਬੀਮਾ ਕੀਤਾ ਵਿਆ ਹੁੰਦਾ ਹੈਗਾ ਈਵਨ ਕਿ ਆਪਣੇ ਜਿਹੜਾ ਕੀ ਆ ਸਾਰੀ ਬੋਡੀ ਦਾ ਬੀਮਾ ਹੁੰਦਾ ਹੈਗਾ ਹੁਣ ਉਹ ਵੀ ਕਰਵਾਉਣੇ ਪਿਆ ਘਰਾਂ ਦੇ ਬੀਮੇ ਵੀ ਹੁੰਦੇ ਹੈਗੇ ਇਹ ਵੀ ਮਹੱਤਵਪੂਰਨ ਹੈਗਾ ਹੁਣ ਦੇਖੋ ਅਸੀਂ ਘਰ ਪਾਇਆ ਅਸੀਂ ਇਹ ਲੋਨ ਲੈ ਕੇ ਘਰ ਪਾਇਆ ਸੀ ਨਾਲ ਨਾਲ ਘਰ ਦਾ ਬੀਮਾ ਵੀ ਕੀਤਾ ਉਹਨਾਂ ਨੇ ਲੋਨ ਬੈਂਕ ਵਾਲਿਆਂ ਨੇ ਠੀਕ ਹੈ ਜੀ ਹੁਣ ਤਾਂ ਦੇਖੋ ਬੀਮਾ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਅਤੇ ਵਿਜੂਅਲ ਥੋੜ੍ਹੀ ਜਿਹੀ ਕਿਸ਼ਤ ਹੁੰਦੀ ਕਿਸ਼ਤ ਅਸੀਂ ਭਰਦੇ ਰਹਿੰਦੇ ਹਾਂ ਪਰ ਇਹਦਾ ਸਾਨੂੰ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈਗਾ ਇਨ ਫਿਊਚਰ ਦੇ ਵਿੱਚ ਇਸ ਲਈ ਜਿਹੜਾ ਬੀਮਾ ਹੈਗਾ ਸਾਰਿਆਂ ਨੂੰ ਹੀ ਕਰਵਾਉਣਾ ਚਾਹੀਦਾ